ਸਾਡੇ ਸਮਾਜ ਦੇ ਸੱਭਿਆਚਾਰ ਵਿੱਚ ਪਰੰਪਰਾਵਾਂ ਹੁਣ ਚੱਲਦੀਆਂ ਨੇਗੀਆਂ ਵੀ ਕੱਪੜੇ ਦੇ ਕਪ ਪਹਿਰਾਵਾ ਕਿਵੇਂ ਦਾ ਹੋਣਾ ਚਾਹੀਦਾ ਆ ਕੱਪੜੇ ਗਹਿਣੇ ਕਿਵੇਂ ਦੇ ਪਾਉਣੇ ਨੇਗੇ ਸਾਰੇ ਵੱਖਰੇ ਵੱਖਰੇ ਹੁੰਦੇ ਨੇ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਸ ਸਾਰੇ ਸਿੰਪਲ ਸਲਵਾਰ ਸੂਟ ਪਾਉਂਦੇ ਨੇਗੇ ਅਤੇ ਇ ਜਿਹੜੇ ਗਹਿਣੇ ਨੇਗੇ ਉਹ ਵੀ ਸਿੰਪਲ ਜੇ ਜਦੋਂ ਵਿਆਹ ਸ਼ਾਦੀ ਹੁੰਦੀ ਉਦੋਂ ਹੀ ਪਾਏ ਜਾਂਦੇ ਨੇ ਅਤੇ ਜਿਹੜੇ ਬਾਕੀ ਹੋਰ ਸ ਬੋਲੀ ਦਾ ਵੀ ਥੋੜ੍ਹਾ ਫਰਕ ਹੈਗਾ ਆ ਸਾਰਿਆਂ ਦਾ ਆਪਣਾ ਆਪਣਾ ਪਹਿਰਾਵਾ ਹੁੰਦਾ ਏ ਲਹਿਜਾ ਹੁੰਦਾ ਹੈਗਾ ਬੋਲਚਾਲ ਦਾ ਪਹਿਨਣੇ ਦਾ ਸਾਰੇ ਸਾਰੇ ਖੇਤਰਾਂ ਦੇ ਵਿੱਚ ਅਲੱਗ ਅਲੱਗ ਹੁੰਦਾ ਹੈਗਾ ਬਾਕੀ ਸਮਾਜ ਨਾਲੋਂ ਸਾਡਾ ਮੈਨੂੰ ਇੰਝ ਲੱਗਦਾ ਵੀ ਜਦੋਂ ਮੈਂ ਬਾਹਰ ਜਾਂਦੀ ਕਿਤੇ ਹੈ ਨਾ ਮੈਨੂੰ ਲਗ ਡਿਫਰੈਂਸ ਮਹਿਸੂਸ ਹੁੰਦਾ ਹੈਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਸ ਜਿਹੜਾ ਸਮਾਜ ਹੈ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਹਜੇ ਜੀਨਸ ਵਗੈਰਾ ਇੰਨਾਂ ਨਹੀਂ ਪਾਉਂਦੀਆਂ ਗਰਲਸ ਪਰ ਜਦੋਂ ਬਾਹਰ ਨਿਕਲ ਕੇ ਪਿੰਡ ਤੋਂ ਬਾਹਰ ਸ਼ਹਿਰਾਂ ਤੋਂ ਬਾਹਰ ਨਿਕਲ ਕੇ ਦੇ ਪਤਾ ਚੱਲਦਾ ਹੈਗਾ ਵੀ ਹਰ ਇੱਕ ਕੁੜੀ ਦੇ ਜੀਨਸ ਪਾਈਆਂ ਹੁੰਦੀਆਂ ਨੇਗੀਆਂ ਉੱਥੇ ਤੋਂ ਹੀ ਪਹਿਰਾਵੇ ਦਾ ਫਰਕ ਸ਼ੁਰੂ ਹੋ ਜਾਂਦਾ ਹੈਗਾ ਅਤੇ ਭਾਈਚਾਰਾ ਇਵੇਂ ਆ ਵੀ ਪਿੰਡਾਂ ਦੇ ਵਿੱਚ ਅੱਜ ਵੀ ਹੈ ਨਾ ਅਸੀਂ ਸਾਰੇ ਘਰਾਂ ਦੇ ਵਿੱਚ ਮਿਲਦੇ ਵਰਤਦੇ ਹਾਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਕੋਈ ਦੁੱਖ ਸੁੱਖ ਹੁੰਦਾ ਸਾਰੇ ਇਕੱਠੇ ਹੁੰਦੇ ਨੇਗੇ ਪਰ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਹੋ ਜਾਂਦਾ ਆ ਵੀ ਉਹਨਾਂ ਦ ਉਹਨਾਂ ਦੇ ਵਿੱਚ ਬਹੁਤ ਫਰਕ ਆ ਅਤੇ ਸਾਰੇ ਹੈ ਨਾ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਹੁੰਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਦਾ ਕੋਈ ਦੁੱਖ ਸੁੱਖ ਦੇ ਵਿੱਚ ਆਉਣ ਜਾਣਾ ਬਸ ਥੋੜ੍ਹੇ ਕੁ ਟਾਈਮ ਨਹੀਂ ਆਉਣਗੇ ਦਸ ਪੰਦਰਾਂ ਮਿੰਟ ਲਈ ਪਰ ਸਾਡੇ ਇੱਧਰ ਸਾਡੇ ਸਮਾਜ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਉੱਥੇ ਇਹ ਆ ਵੀ ਹੈ ਨਾ ਦੁੱਖ ਸੁੱਖ ਵੇਲੇ ਹਰ ਟੈਮ ਹਰ ਟੈਮ ਨਾਲ ਨਾਲ ਰਹਿਣਾ ਉਹਨਾਂ ਦਾ ਦੁੱਖ ਵੰਡਾਉਣਾ ਅਤੇ ਖੁਸ਼ੀਆਂ ਨੂੰ ਵੰਡਣਾ ਇੱਕ ਦੂਜੇ ਦੇ ਨਾਲ ਸਾਡੇ ਸਮਾਜ ਦਾ ਹਿੱਸਾ ਆ